ਯੋਗਾ ਇੱਕ ਚੁਸਤ ਫੁਰਤੀ ਦਾ ਕਾਰਨ ਹੁੰਦਾ ਹੈ ਇਸ ਕਰਕੇ ਯੋਗਾ ਕਰਨ ਨਾਲ ਸਾਡੇ ਸਰੀਰ ਦੀ ਮਾਸਪੇਸ਼ੀਆਂ ਨੂੰ ਖੁਲ੍ਹਾ ਖੁੱਲ੍ਹ ਜਾਂਦੀਆਂ ਹਨ ਅਤੇ ਕਾਫ਼ੀ ਚੁਸਤ ਫੁਰਤੀ ਹੋ ਜਾਂਦਾ ਹੈ ਇੱਕ ਵਾਰੀ ਮੈਂ ਮੈਂ ਗਰਮ ਯੋਗਾ ਕੀਤਾ ਸੀ ਜਿਸ ਨਾਲ ਸਾਡੀਆਂ ਮਾਸਪੇਸ਼ੀਆਂ ਦੇ ਵਿੱਚ ਕਾਫ਼ੀ ਫੁਲਾਵਟ ਹੋ ਜਾਂਦੀ ਹੈ ਅਤੇ ਇਹ ਜਿਮ ਦੇ ਵਿੱਚ ਵੀ ਕਾਫ਼ੀ ਸਰੀਰ ਨੂੰ ਕਰਨ ਨਾਲ ਗਰਮੀ ਅਤੇ ਫੁਰ ਫਰਤੀਲੀ ਹੋ ਜਾਂਦੀ ਹੈ ਇਸ ਕਰਕੇ ਗਰਮ ਯੋਗਾ ਯੋਗਾ ਦੀ ਦਾ ਤਾਪਮਾਨ ਇਹ ਪਚਾਨਵੇਂ ਤੋਂ ਸੌ ਪ੍ਰਸੈਂਟ ਤੱਕ ਹੋ ਜਾਂਦਾ ਹੈ ਜਿਸ ਕਰਕੇ ਇਸ ਜਿਸ ਕਰਕੇ ਸਾਡੀ ਸਾਡੀ ਫਿਟਨੈਸ ਰਹਿੰਦੀ ਹੈ ਅਤੇ ਕਾਫ਼ੀ ਫੁਰਤੀਲੀ ਰਹਿੰਦਾ ਹੈ ਗਰਮ ਯੋਗਾ ਕਰਨ ਨਾਲ ਸਾਡਾ ਸਾਰੇ ਸਰੀਰ ਦੀ ਗਰਮੀ ਪਸੀਨਾ ਬਾਹਰ ਨਿਕਲ ਆਉਂਦਾ ਹੈ ਜਿਸ ਕਰਕੇ ਸਾਡੇ ਸਾਡੇ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਇਸ ਨੂੰ ਰੈਗੂਲਰ ਤਾਂ ਨਹੀਂ ਕਰਨਾ ਚਾਹੀਦਾ ਹੈ ਹਫ਼ਤੇ 'ਚ ਇੱਕ ਦੋ ਵਾਰੀ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਸਾਡਾ ਮਾਨਸਿਕ ਤਲ ਸੰਤੁਲਨ ਬਣਿਆ ਰਹਿੰਦਾ ਹੈ